ਲੰਬੇ ਸਫਰ ਬਾਈਕਿੰਗ ਵਿੱਚ ਮੈਂ ਕੁਝ ਕੁ ਕਿਲੋਮੀਟਰ ਚਲਾ ਕੇ ਰੁਕ ਜਾਂਦਾ ਹਾਂ ਆਪਣੇ ਕੋਲ ਪਾਣੀ ਜਾਂ ਗੁਲੂਕੋਸ ਹਮੇਸ਼ਾ ਰੱਖਦਾ ਹਾਂ ਤਾਬਿਆ ਜਾਂ ਚਾਹ ਦੇ ਖੋਕਿਆਂ 'ਤੇ ਰੁਕ ਕੇ ਚਾਹ ਪਾਣੀ ਪੀਂਦੇ ਹਾਂ ਅਤੇ ਖੁਸ਼ ਰਹਿ ਕੇ ਬਾਈਕ ਚਲਾਉਂਦੇ ਹਾਂ ਢਾਬਿਆਂ 'ਤੇ ਰੁਕ ਕੇ ਹਲਕਾ ਫੁਲਕਾ ਹੀ ਖਾਣਾ ਪਸੰਦ ਕਰਦੇ ਹਾਂ ਤਾਂ ਜੋ ਰਸਤਿਆਂ ਵਿੱਚ ਪਰੇਸ਼ਾਨੀ ਨਾ ਹੋਵੇ ਕਈ ਵਾਰ ਜੂਸ ਗੰਨੇ ਦਾ ਰਸ ਚਾਹ ਫਲ ਜਾਂ ਕੌਫੀ ਖਾਣਾ ਪਸੰਦ ਕਰਦੇ ਹਾਂ ਜਿਆਦਾਤਰ ਮੈਂ ਆਪਣੇ ਦੋਸਤਾਂ ਨਾਲ ਹੀ ਬਾਈਕਿੰਗ ਕਰਨਾ ਪਸੰਦ ਕਰਦਾ ਹਾਂ ਕਿਉਂਕਿ ਅਸੀਂ ਅਦਲ ਬਦਲ ਨਾਲ ਬਾਈਕ ਚਲਾਉਂਦੇ ਹਾਂ ਕਈ ਵਾਰ ਇਕੱਲੇ ਹੀ ਬਾਈਕ ਚਲਾਉਣਾ ਦਾ ਮੌਕਾ ਮਿਲਦਾ ਹੈ ਤਾਂ ਪਿੱਠ ਜਾਂ ਮੋਢੇ ਦੀ ਦਰਦ ਦਾ ਅਨੁਭਵ ਹੋਣਾ ਅਤੇ ਦੂਰ ਸਮੇਂ ਆਰਾਮ ਕਰਕੇ ਚਲਾਉਣਾ ਹੈ ਬਾਈਕ ਨੂੰ ਆਪਣੇ ਸਰੀਰ ਮੁਤਾਬਿਕ ਤੇਜ਼ ਜਾਂ ਹੌਲੀ ਚਲਾਣ ਸਕਦੇ ਹਾਂ